ਮੈਂ ਆਪਣੇ ਪਰਿਵਾਰ ਮੈਂਬਰਾਂ ਨੂੰ ਇਹ ਸਮਝਾਉਣਾ ਚਾਹਵਾਂਗੀ ਕਿ ਇਸ ਫਿਲਮ ਨਾਲ ਸਾਡੇ ਗਿਆਨ ਵਿੱਚ ਵਾਧਾ ਹੋਵੇਗਾ ਸਾਨੂੰ ਸੰਦੇਸ਼ ਮਿਲੇਗਾ ਕਿ ਅਸੀਂ ਕਿਸ ਸਮੱਸਿਆ ਨਾਲ ਜੂਝ ਰਹੇ ਹਾਂ ਅਤੇ ਉਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ ਮੈਂ ਉਹਨਾਂ ਨੂੰ ਬੁਕਿੰਗ ਸੰਦਰਭ ਨੰਬਰ ਪ੍ਰਦਾਨ ਕਰਾਂਗੀ ਅਤੇ ਉਹਨਾਂ ਨੂੰ ਆਪਣੀ ਸਥਿਤੀ ਦੀ ਜਾਂਚ ਕਰਨ ਲਈ ਕਹਾਂਗੀ ਉਹਨਾਂ ਨੂੰ ਸਮਝਾਵਾਂਗੀ ਇਸ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕੀ ਮੇਰਾ ਪਰਿਵਾਰ ਸ਼ ਸ਼ਹਿਰ ਤੋਂ ਬਾਹਰ ਆ ਰਿਹਾ ਹੈ ਤੁਸੀਂ ਮੈਂ ਉਹਨਾਂ ਦੀ ਟਿਕ ਰਾਤ ਦੀ ਟਿਕਟਾਂ ਬੁੱਕ ਕੀਤੀਆਂ ਹਨ ਜਿਸ ਕਰਕੇ ਉਹਨਾਂ ਨੂੰ ਸਮਝਾਵਾਂਗੀ ਇਸ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ